ਮੈਂ ਇਹੀ ਸਲਾਹ ਦੇਵਾਂਗਾ ਜੋ ਕਿ ਯੋਗਾ ਵਿੱਚ ਨਵੇਂ ਹਨ ਜੋ ਸ਼ੋ ਹੋਣੀ ਹੁਣੀ ਸ਼ੁਰੂ ਕੀਤਾ ਹੈ ਉਹਨਾਂ ਨੇ ਯੋਗਾ ਸਭ ਤੋਂ ਪਹਿਲਾਂ ਤਾਂ ਉਹ ਸ਼ੁਰੂ ਕਰਨ ਧਿਆਨ ਮੁਦਰਾ ਜੋ ਕਿ ਯੋਗਾ ਦਾ ਪਹਿਲਾ ਹੀ ਪਹਿਲੀ ਹੀ ਕਲਾਸ ਹੈ ਆਪਾਂ ਕਹਿ ਦਈਏ ਜਦੋਂ ਧਿਆਨ ਮੁੰਦਰੇ 'ਚ ਪੱਕੇ ਹੋਗੇ ਅੱਗੇ ਯੋਗਾ ਤੁਹਾਨੂੰ ਕਠਿਨ ਨਹੀਂ ਲੱਗਣਾ ਹੈ ਹਾਂ ਹਰੇਕ ਚੀਜ਼ ਜਿਵੇਂ ਆਪਾਂ ਦਵਾਈ ਖਾਨੇ ਨਾ ਕੌੜੀ ਦਵਾਈ ਖਾਨੇ ਉਹ ਬਾਅਦ 'ਚ ਆਪਣੇ ਸਰੀਰ ਦੇ ਰੋਗ ਤੋੜਦੇ ਹੁੰਦੀ ਕੋੜੀ ਹੈ ਇਵੇਂ ਹੀ ਯੋਗਾ ਹੈ ਲੱਗਦਾ ਔਖਾ ਏ ਪਰ ਫਾਇਦੇ ਆਪਾਂ ਨੂੰ ਹੌਲੀ ਹੌਲੀ ਉਹਦੇ ਬਾਅਦ 'ਚ ਪਤਾ ਲੱਗਦੇ ਉਹਦਾ ਨੁਕਸਾਨ ਜ਼ੀਰੋ ਪਰਸੇਂਟ ਉਹਨਾਂ ਨੂੰ ਇਹ ਸਲਾਹ ਦੇਵਾਂਗਾ ਪਹਿਲਾਂ ਧਿਆਨ ਮੁੰਦਰਾਂ 'ਚ ਪੱਕੇ ਹੋ ਇੱਕੇ ਆਸਣ ਕਰੋ ਧਿਆਨ ਮੁੰਦਰਾ ਡੇਲੀ ਸਵੇਰੇ ਉੱਠੋ ਸੂਰਜ ਚੜਨ ਤੋਂ ਪਹਿਲਾਂ ਉਹਦੇ 'ਚ ਬੈਠ ਕੇ ਸ਼ਾਂਤ ਜਗ੍ਹਾ ਧਿਆਨ ਮੁੰਦਰਾ ਕਰੋ ਜਿਸ ਨਾਲ਼ ਉਹਨਾਂ ਨੂੰ ਅੱਗੇ ਅੱਗੇ ਆਸਣ ਲਾਉਣ 'ਚ ਵੀ ਉਹਨਾਂ ਦਾ ਧਿਆਨ ਲੱਗੇਗਾ ਕੋਨਸਟਰੇਸ਼ਨ ਵਧੇਗੀ ਉਹਨਾਂ ਦੇ ਮਨ ਨੂੰ ਸ਼ਾਂਤੀ ਪਏਗੀ ਅਤੇ ਉਹ ਇਹ ਹਰ ਰੋਜ਼ ਕਰਨ ਜਿਸ ਨਾਲ਼ ਉਹਨਾਂ ਨੂੰ ਅੱਗੇ ਵਾਲੀ ਮੁੰਦਰਾਂ ਆਸਣ ਸੌਖੇ ਲੱਗਣਗੇ